ਸਤਿ ਸ਼੍ਰੀ ਅਕਾਲ ਜੀ ਹਾਂਜੀ ਜੀ ਟੈਕਨੋਲੋਜੀ ਬਾਰੇ ਆਪਾਂ ਗੱਲ ਕਰਨ ਲੱਗੇ ਹਾਂ ਟੈਕਨੋਲਜੀ ਨੇ ਜਿਹੜਾ ਵਾ ਉਹ ਅੱਜ ਦੇ ਸਮਾਜ ਨੂੰ ਬਹੁਤ ਹੀ ਜ਼ਿਆਦਾ ਬਦਲ ਕੇ ਜਿਹੜਾ ਵਾ ਉਹ ਰੱਖ ਦਿੱਤਾ ਵਾ ਅਤੇ ਇਹਦੇ ਬਹੁਤ ਜ਼ਿਆਦਾ ਜਿਹੜਾ ਵਾ ਚੰਗੇ ਪੱਖ ਇਨਸਾਨ ਦੇ ਸਾਹਮਣੇ ਆਏ ਆ ਜਿਵੇਂ ਪਿੱਛੇ ਜੇ ਕਰੋਨਾ ਆਇਆ ਸੀ ਅਤੇ ਕਰੋਨਾ ਦੇ ਵਿੱਚ ਜੇ ਆਪਾਂ ਵੇਖ ਸਕਦੇ ਹਾਂ ਕਿ ਸਾਰਾ ਕੁਝ ਠੱਪ ਹੋ ਗਿਆ ਸੀ ਬੱਚਿਆਂ ਦੀ ਜਿਵੇਂ ਪੜ੍ਹਾਈ ਨੂੰ ਲੈ ਲਓ ਤੁਸੀਂ ਕਿ ਸਕੂਲ ਬੰਦ ਹੋ ਗਏ ਸੀ ਬੱਚੇ ਪੜ੍ਹ ਨਹੀਂ ਪਾ ਰਹੇ ਸੀ ਅਤੇ ਟੈਕਨੋਲੋਜੀ ਦੇ ਕਾਰਨ ਜਿਹੜਾ ਔਨਲਾਈਨ ਕਲਾਸਾਂ ਲਗਾਈਆਂ ਗਈਆਂ ਟੀਚਰਾਂ ਦੁਆਰਾ ਘਰ ਬੈਠੇ ਬੈਠੇ ਬੱਚਿਆਂ ਨੂੰ ਜਿਹੜਾ ਵਾ ਉਹ ਹੋਮਵਰਕ ਜਿਹੜਾ ਵਾ ਓਹ ਸਕੂਲ ਦਾ ਕੰਮ ਜਿਹੜਾ ਵਾ ਉਹ ਕਰਵਾਇਆ ਗਿਆ ਇਹਦੇ ਨਾਲ਼ ਜਿਹੜਾ ਵਾ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਵੀ ਨਹੀਂ ਹੋਇਆ ਅਤੇ ਸਮਾਂ ਦਾ ਵੀ ਜਿਹੜਾ ਵਾ ਉਹ ਚੰਗਾ ਉਪਯੋਗ ਜਿਹੜਾ ਵਾ ਉਹ ਹੋ ਗਿਆ ਇਸ ਤੋਂ ਇਲਾਵਾ ਜਿਵੇਂ ਆਪਾਂ ਆਪਣੇ ਕੋਲ ਅੱਜ ਕੱਲ੍ਹ ਇੰਟਰਨੈੱਟ ਦੀ ਸਹੂਲਤ ਆ ਆਪਾਂ ਇੱਕ ਦੇਸ਼ ਵਿੱਚ ਬੈਠੇ ਦੂਜੇ ਦੇਸ਼ ਵਿੱਚ ਰਹਿੰਦੇ ਆਪਣੇ ਰਿਸ਼ਤੇਦਾਰਾਂ ਨਾਲ਼ ਜਿਹੜੀ ਆ ਉਹ ਗੱਲਬਾਤ ਕਰ ਸਕਦੇ ਹਾਂ ਜਿਹੜੀ ਅੱਜ ਕੱਲ੍ਹ ਵੀਡੀਓ ਕੋਲ ਚੱਲੀ ਹੈਗੀ ਆ ਉਹਦੇ ਨਾਲ਼ ਜਿਹੜਾ ਵਾ ਇੱਕ ਦੂਜੇ ਨੂੰ ਵੇਖ ਕੇ ਅਸੀਂ ਗੱਲਬਾਤ ਕਰ ਸਕਦੇ ਹਾਂ ਇਹ ਇੱਕ ਬਹੁਤ ਹੀ ਜਿਹੜਾ ਵਾ ਵੱਡਾ ਬਦਲਾਵ ਆ ਟੈਕਨੋਲੋਜੀ ਕਾਰਨ ਸਮਾਜ ਦੇ ਵਿੱਚ ਅਤੇ ਜਿਹਦਾ ਬਹੁਤ ਜ਼ਿਆਦਾ ਜਿਹੜਾ ਵਾ ਉਹ ਫਾਇਦਾ ਵੀ ਹੋਇਆ ਹੁਣ ਆਪਾਂ ਕਿਸੇ ਦੇਸ਼ ਤੋਂ ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਜਾਣਾ ਵਾ ਉਹਦੇ ਲਈ ਸਾਨੂੰ ਟਿਕਟਾਂ ਚਾਹੀਦੀਆਂ ਵਾਂ ਇੱਥੋਂ ਤੱਕ ਕਿ ਅਸੀਂ ਆਪਣੇ ਦੇਸ਼ ਵਿੱਚ ਹੀ ਸਫ਼ਰ ਕਰਨਾ ਵਾ ਅਤੇ ਸਾਨੂੰ ਕੋਈ ਰੇਲ ਦੀ ਟਿਕਟ ਚਾਹੀਦੀ ਆ ਅਤੇ ਉਹ ਅਸੀਂ ਆਪਣੇ ਫ਼ੋਨ ਦੇ ਜਿਹੜਾ ਵਾ ਰਾਹੀਂ ਘਰ ਬੈਠੇ ਬੈਠੇ ਉਹ ਟਿਕਟ ਜਿਹੜੀ ਆ ਉਹ ਕਰਵਾ ਲੈਂਦੇ ਹਾਂ ਇਹਨੂੰ ਬਹੁਤ ਵੱਡਾ ਜਿਹੜਾ ਇਨਸਾਨ ਦੀ ਇਹਦੇ ਨਾਲ਼ ਜਿਹੜਾ ਵਾ ਸਮੇਂ ਦੀ ਵੀ ਬੱਚਤ ਹੁੰਦੀ ਆ ਅਤੇ ਉਹਨੂੰ ਆਉਣ ਜਾਣ ਦਾ ਜਿਹੜਾ ਵਾ ਉਹ ਝੰਜਟ ਜਿਹੜਾ ਉਹਦੇ 'ਚ ਨਹੀਂ ਪੈਣਾ ਪੈਂਦਾ ਠੀਕ ਹੈ ਇਸ ਤੋਂ ਇਲਾਵਾ ਜਿਵੇਂ ਆਪਾਂ ਅੱਜ ਕੱਲ੍ਹ ਜਿਹੜੀ ਆ ਉਹ ਬੱਚੇ ਖਰੀਦਦਾਰੀ ਕਰਦੇ ਆ ਆਪਣੇ ਘਰਾਂ ਵਿੱਚ ਜਿਹੜਾ ਸੌਦਾ ਮੰਗਵਾ ਲੈਂਦੇ ਸਮਾਨ ਮੰਗਵਾ ਲੈਂਦੇ ਆ ਔਨਲਾਈਨ ਉਹ ਵੀ ਇੱਕ ਟੈਕਨੋਲੋਜੀ ਦੇ ਨਾਲ਼ ਹੀ ਜਿਹੜਾ ਵਾ ਉਹ ਸੰਭਵ ਆ ਆਪਣੇ ਫ਼ੋਨ ਦੇ ਉੱਤੋਂ ਉਹ ਔਰਡਰ ਕਰਦੇ ਆ ਅਤੇ ਫਿਰ ਉਹ ਸਮਾਨ ਘਰ ਉਹਨਾਂ ਦੇ ਪਹੁੰਚਾ ਦਿੱਤਾ ਜਾਂਦਾ ਵਾ ਫਿਰ ਉਹਦੇ ਬਦਲੇ ਉਹ ਜਿਹੜਾ ਵਾ ਭੁਗਤਾਨ ਜਿਹੜਾ ਵਾ ਕੀਤਾ ਜਾਂਦਾ ਵਾ ਟੈਕਨੋਲੋਜੀ ਨੇ ਆਪਾਂ ਸੌਖੇ ਸਬਜਾਂ ਸ਼ਬਦਾਂ ਵਿੱਚ ਕਹੀਏ ਅਤੇ ਇੱਕ ਤਰ੍ਹਾਂ ਇਨਸਾਨ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤਾ ਵਾ ਟੈਕਨੋਲੋਜੀ ਜਿਹੜੀ ਆ ਉਹ ਇੱਕ ਪਰਿਵਾਰ ਦਾ ਹਿੱਸਾ ਬਣ ਚੁੱਕੀ ਅੱਜ ਦਾ ਜਿਹੜੇ ਫ਼ੋਨ ਲੈ ਲਓ ਜਾਂ ਤੁਸੀਂ ਬਿਜਲੀ ਦੀ ਸਹੂਲਤ ਲੈ ਲਓ ਟੈਕਨੋਲੋਜੀ ਨਾਲ਼ ਵਾਧਾ ਹੋਇਆ ਇਹਨਾਂ ਚੀਜ਼ਾਂ ਵਿੱਚ ਵੀ ਠੀਕ ਹੈ ਇਹ ਜਿਹੜੀ ਵੀ ਆ ਇੱਕ ਮਤਲਬ ਕਿ ਅਨਿੱਖੜਵਾਂ ਅੰਗ ਜਿਹੜਾ ਇਨਸਾਨ ਦਾ ਬਣ ਗਈ ਹੈ ਅਤੇ ਇਹਦੇ ਤੋਂ ਬਿਨਾਂ ਜਿਹੜਾ ਹੁਣ ਇਨਸਾਨ ਦੀ ਜਿਹੜੀ ਜ਼ਿੰਦਗੀ ਆ ਉਹਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਕਿ ਇਨਸਾਨ ਦੀਆਂ ਜ਼ਰੂਰਤਾਂ ਜਿਹੜੀਆਂ ਵਾ ਉਹ ਟੈਕਨੋਲਜੀ 'ਤੇ ਹੀ ਨਿਰਭਰ ਕਰਦੀਆਂ ਵਾ ਠੀਕ ਹੈ ਜੀ ਇਸ ਲਈ ਮੈਂ ਤੁਹਾਨੂੰ ਇਹੋ ਕਹੂੰਗੀ ਕਿ ਜਿੰਨੀਆਂ ਵੀ ਟੈਕਨੋਲੋਜੀ ਦੇ ਆਉਣ ਦੇ ਨਾਲ਼ ਸਮਾਜ ਵਿੱਚ ਜੋ ਵੀ ਬਦਲਾਵ ਹੋਇਆ ਵਾ ਉਹਦਾ ਚਾਹੇ ਉਹ ਟਿਕਟਾਂ ਬੁੱਕ ਕਰਨੀਆਂ ਵਾ ਚਾਹੇ ਕੋਈ ਬੈਂਕਿੰਗ ਨਾਲ਼ ਸੰਬੰਧਿਤ ਕੋਈ ਵੀ ਭੁਗਤਾਨ ਕਰਨਾ ਵਾ ਲੈਣ ਦੇਣ ਕਰਨਾ ਵਾ ਉਹ ਸਭ ਦੇ ਵਿੱਚ ਜਿਹੜਾ ਵਾ ਟੈਕਨੋਲੋਜੀ ਨੇ ਬਹੁਤ ਵੱਡਾ ਜਿਹੜਾ ਰੋਲ ਆਪਣਾ ਨਿਭਾਇਆ ਹੈ ਅਤੇ ਨਿਭਾ ਰਹੀ ਹੈ ਅਤੇ ਹੁਣ ਇਹਨੂੰ ਆਪਾਂ ਇਨਸਾਨ ਦੇ ਜ਼ਿੰਦਗੀ ਦਾ ਇੱਕ ਅਨਿੱਖੜਵਾਂ ਜਿਹੜਾ ਵਾ ਉਹ ਅੰਗ ਕਹਿ ਸਕਦੇ ਹਾਂ ਕਿਉਂਕਿ ਇਹਦੇ 'ਤੇ ਬਿਨਾਂ ਇਨਸਾਨ ਦਾ ਅੱਗੇ ਵਧਣਾ ਜਿਹੜਾ ਵਾ ਉਹ ਅੱਜ ਦੇ ਸਮੇਂ ਵਿੱਚ ਜਿਹੜਾ ਉਹ ਸੰਭਵ ਨਹੀਂ ਹੈ ਠੀਕ ਹੈ ਜੀ ਧੰਨਵਾਦ